ਅੱਜ ਦੇ ਆਧੁਨਿਕ ਸਮੇਂ ਵਿੱਚ ਸੰਸਾਰ ਵਿਕਾਸ ਕਰ ਰਿਹਾ ਹੈ ਸੰਸਾਰ ਭਰ ਵਿੱਚ ਆਵਾਜਾਈ ਦੇ ਸਾਧਨ ਵਿੱਦਿਆ ਦੇ ਸਾਧਨ ਸ਼ੋਸ਼ਲ ਮੀਡੀਆ ਟੈਕਨੋਲਜੀ ਦੇ ਸਾਧਨ ਹੋਣ ਕਾਰਨ ਸੰਸਾਰ ਬਦਲ ਰਿਹਾ ਹੈ ਅੱਜ ਦੇ ਸਮੇਂ ਵਿੱਚ ਟੈਕਨੋਲਜੀ ਦੇ ਸਾਧਨਾਂ ਕਰਕੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਸੰਸਾਰ ਦਾ ਹਰ ਇੱਕ ਦੇਸ਼ ਵਿਕਸਿਤ ਹੋ ਰਿਹਾ ਹੈ ਅਤੇ ਦੁਨੀਆਂ ਬਦਲ ਰਹੀ ਹੈ